ਜੇ ਆਪਣੇ ਮਨੋਰੰਜਨ ਦੀ ਗਤੀਵਿਧੀਆਂ ਬਾਰੇ ਗੱਲ ਕਰੀਏ ਤਾਂ ਆਪਣੇ ਪਿੰਡਾਂ ਨੂੰ ਜਿਹੜਾ ਮਨੋਰੰਜਨ ਹੁੰਦਾ ਜਿਵੇਂ ਵਿਆਹ ਸ਼ਾਦੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਹੋਣਾ

ਪਿੰਡਾਂ ਦੇ ਵਿੱਚ ਮੇਲੇ ਵੀ ਬੜੇ ਲੱਗਦੇ ਆ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਉੱਥੇ ਭੋਗ ਉੱਥੇ ਵੀ ਮਨੋਰੰਜਨ ਹੁੰਦਾ ਅਖਾੜੇ 'ਤੇ ਪਿੰਡਾਂ ਦੇ ਵਿੱਚ ਖੇਡਾਂ ਉਹਨਾਂ ਦਾ ਵੀ ਮਨੋਰੰਜਨ ਹੁੰਦਾ ਬੜਾ ਅਤੇ ਪਿੰਡ ਦੇ ਵਿੱਚ ਬਾਜੀ ਪਾਉਣ ਵਾਲੇ ਜਾਂ ਖੇਡਾ ਕਰਨ ਵਾਲੇ ਉਹ ਬੜੇ ਆਉਂਦੇ ਆ ਅਤੇ ਪਿੰਡਾਂ ਦੇ ਵਿੱਚ ਮੈਦਾਨ ਖੁੱਲ੍ਹੇ ਹੁੰਦੇ ਆ ਉੱਥੇ ਕਬੱਡੀ ਕਰਵਾਉਂਦੇ ਆ ਕਿਰਕਟ ਕਰਵਾਉਂਦੇ ਆ ਉਹਨਾਂ ਦਾ ਵੀ ਮਨੋਰੰਜਨ ਬੜਾ ਹੁੰਦਾ ਟੂਰਨਾਮੈਂਟ ਹੁੰਦੇ ਆ ਵੱਡੇ ਉਹਨਾਂ ਦੇ ਮਨੋਰੰਜਨ ਬੜਾ ਹੁੰਦਾ ਆ ਧੰਨਵਾਦ